ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਮਾਨਦੀਪ ਸਿੰਘ ਹੈ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਸਾਡੇ ਪਿੰਡ ਵਿੱਚ ਡਾਟਾ ਬੇਸ ਦੀਆਂ ਬਹੁਤ ਫਸਿਲਟੀਆਂ ਹਨ ਬਹੁਤ ਟੈਕਨੋਲ ਬਹੁਤ ਨਵੀਆਂ ਟੈਕਨੋਲਜੀ ਆਈਆਂ ਹਨ ਜਿਸ ਕਾਰਨ ਸਾਨੂੰ ਬਹੁਤ ਮਦਦ ਮਿਲੀ ਹੈ ਜਿਵੇਂ ਕਿ ਕੰਪਿਊਟਰ ਨਾਲ ਸਾਡਾ ਸਾਰਾ ਕੰਮ ਸੌਖਾ ਹੋ ਗਿਆ ਹੈ ਜਿਵੇਂ ਅਸੀਂ ਕਿਸੇ ਨੂੰ ਆਨਲਾਈਨ ਮਨੀ ਟ੍ਰਾਂਸਫਰ ਕਰਨੀ ਹੁੰਦੀ ਹੈ ਤਾਂ ਅਸੀਂ ਕੰਪਿਊਟਰ ਨਾਲ ਕਰ ਸਕਦੇ ਹਾਂ ਇਹ ਟੈਕਨੋਲੋਜੀ ਰਾਹੀਂ ਸਾਨੂੰ ਬਹੁਤ ਹੀ ਜ਼ਿਆਦਾ ਬਹੁਤ ਹੀ ਮਦਦ ਮਿਲੀ ਹੈ ਜਿਸ ਨਾਲ ਅਸੀਂ ਬਹੁਤ ਛੇਤੀ ਨਾਲ ਆਪਣਾ ਕੰਮ ਨੂੰ ਕਰ ਸਕਦੇ ਹਾਂ ਕਈ ਟੈਕਨੋਲਜੀਆਂ ਨਾਲ ਅਸੀਂ ਘਰ ਬੈਠੇ ਹੀ ਕਮਾ ਵੀ ਸਕਦੇ ਹਾਂ ਵਰਕ ਫਰੋਮ ਹੋਮ ਵੀ ਅਸੀਂ ਫੋਨਾਂ ਦੇ ਰਾਹੀਂ ਕਰ ਸਕਦੇ ਹਾਂ ਇਹਨਾਂ ਟੈਕਨੋਲਜੀਆਂ ਨਾਲ ਸਾਨੂੰ ਬਹੁਤ ਹੀ ਵਧੀਆ ਲੱਗਦੀਆਂ ਇਹ ਟੈਕਨੋਲਜੀਆਂ ਸਾਨੂੰ ਬਹੁਤ ਹੀ ਵਧੀਆ ਲੱਗਦੀਆਂ ਹਨ ਇਹ ਟੈਕਨੋਲਜੀਆਂ ਕਾਰਨ ਸਾਡਾ ਕੰਮ ਬਹੁਤ ਬਹੁਤ ਸ਼ ਸੌਖਾ ਹੋ ਗਿਆ ਹੈ ਜਿਵੇਂ ਅਸੀਂ ਕਿਤੇ ਵੀ ਕੰਮ ਕਰਨ ਜਾਈਏ ਤਾਂ ਕੰਪਿਊਟਰ ਦੀ ਹਰ ਥਾਂ ਵਿੱਚ ਲੋੜ ਤਾਂ ਪੈਂਦੀ ਹੈ ਤਾਂ ਅਸੀਂ ਘਰੋਂ ਕੰਪਿਊਟਰ ਲੈ ਜਾਂਦੇ ਹਾਂ ਤਾਂ ਉਸ ਨਾਲ ਅਸੀਂ ਕੰਮ ਕਰ ਦਿੰਦੇ ਹਾਂ ਅੱਜ ਕੱਲ੍ਹ ਕੰਪਿਊਟਰ ਸ ਸਾਰੀਆਂ ਚੀਜ਼ਾਂ ਟੈਕਨੋਲਜੀ 'ਤੇ ਬੇਸਡ ਹਨ ਕਾਰਾਂ ਮੋਟਰਸਾਈਕਲ ਸਭ ਕੁਝ ਅਸੀਂ ਕਈ ਕਾਰਾਂ ਦੇ ਲੋਕ ਕੰਪਿਊਟਰ ਨਾਲ ਵੀ ਖੋਲ੍ਹੇ ਹਨ ਜਿਹੜੀਆਂ ਕਿ ਬਹੁਤ ਮਹਿੰਗੀਆਂ ਕਾਰਾਂ ਹਨ ਕਾਰਾਂ ਸਾਨੂੰ ਬਹੁਤ ਵਧੀਆ ਲੱਗਦੀਆਂ ਹਨ ਕਿਹੜੀਆਂ ਹ ਨਵੀਆਂ ਚੱਲੀਆਂ ਹਨ ਉਹ ਸੈਂਸਰ ਵਾਲੀਆਂ ਹਨ ਉਹ ਕੰਪਿਊਟਰ ਨਾਲ ਹੀ ਸੈਂਸਰਾਂ ਨੂੰ ਅਸੀਂ ਵਧੀਆ ਅਪਡੇਟ ਅਪਗ੍ਰੇਡ ਵੀ ਕਰ ਸਕਦੇ ਹਾਂ ਕੰਪਿਊਟਰ ਰਾਹੀਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ